ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਅਤੇ ਮੈਂ ਗੜ ਬੱਗਾ ਪਿੰਡ ਦਾ ਰਹਿਣ ਵਾਲਾ ਹਾਂ ਅਸੀਂ ਆਪਣੇ ਘਰਦਿਆਂ ਨਾਲ ਬਾਹਰ ਕਿਤੇ ਘੁੰਮਣ ਆਏ ਹੋਏ ਹਾਂ ਅਤੇ ਅਸੀਂ ਤੁਹਾਡੀ ਏਜੰਸੀ ਦੁਆਰਾ ਭੇਜੇ ਗਏ ਡਰਾਈਵਰ ਦੇ ਨਾਲ ਆਏ ਹੋਏ ਹਾਂ ਅਤੇ ਤੁਹਾਡੀ ਏਜੰਸੀ ਦਾ ਜਾ ਜੋ ਡਰਾਈਵਰ ਹੈ ਇਸ ਨੂੰ ਬੋਲਣ ਦੀ ਬਿਲਕੁਲ ਵੀ ਅਕਲ ਨਹੀਂ ਹੈ ਅਤੇ ਜਦੋਂ ਅਸੀਂ ਇਸ ਨੂੰ ਕਿਹਾ ਕਿ ਗੱਡੀ ਦੇ ਅੰਦਰ ਮਾਸਕ ਪਾ ਕੇ ਬੈਠ ਜਾ ਤਾਂ ਇਹ ਕਹਿ ਰਿਹਾ ਕਿ ਮੈਨੂੰ ਕਿਹੜਾ ਕਿਸੇ ਨੇ ਮੈਨੂੰ ਕਿਹੜਾ ਕੁਛ ਹੋ ਰਿਹਾ ਅਸੀਂ ਸਾਰੇ ਘਰਦਿਆਂ ਦੇ ਨਾਲ ਮਾਸਕ ਪਾ ਕੇ ਬੈਠੇ ਅਤੇ ਇਹ ਇਕੱਲਾ ਹੀ ਬਿਨਾ ਮਾਸਕ ਤੋਂ ਬੈਠਾ ਹੋਇਆ ਹੈ ਅਤੇ ਇਸ ਨੇ ਗੱਡੀ ਵੀ ਬਿਲਕੁਲ ਸਾਫ਼ ਨਹੀਂ ਕੀਤੀ ਹੋਈ ਗੱਡੀ ਦੀਆਂ ਸੀਟਾਂ ਗੱਡੀ ਆਂ ਅੰਦਰ ਤੋਂ ਮੁਸ਼ਕ ਆ ਰਹੀ ਹੈ ਬਦਬੂ ਆ ਰਹੀ ਹੈ ਮਨ ਭਿੱਟ ਹੋ ਰਿਹਾ ਹੈ ਸਾਡੇ ਬੱਚਿਆਂ ਦਾ ਸਾਡੇ ਘਰਦਿਆਂ ਤੋਂ ਨਹੀਂ ਬੈਠ ਹੋ ਰਿਹਾ ਅਤੇ ਲੰਬਾ ਬਹੁਤ ਸਫਰ ਹੈ ਅਤੇ ਜੇ ਡਰਾਈਵਰ ਨੂੰ ਕਹੋ ਕਿ ਤੂੰ ਰੋ ਵੀ ਤੂੰ ਕੌਣ ਹੁੰਦਾ ਸਾਨੂੰ ਬੋਲਣ ਵਾਲਾ ਤਾਂ ਡਰਾਈਵਰ ਅੱਗੋਂ ਕਹਿੰਦਾ ਤੁਸੀ ਫੇਰ ਉੱਤਰ ਜਾਉ ਉਰੇ ਤੁਹਾਨੂੰ ਕੋਈ ਦਿੱਕਤ ਹੈ ਫੇਰ ਤੁਸੀ ਉੱਤਰ ਜਾਉ ਮੈਂ ਇਕੱਲਾ ਹੀ ਚਲਾ ਜਾਂਦਾ ਹਾਂ ਇਸ ਕਰਕੇ ਤੁਸੀਂ ਆਪਣੇ ਡਰਾਇਵਰ ਨੂੰ ਸਮਝਾਉ ਕੁਛ ਅਤੇ ਆਪਣੇ ਡਰਾਈਵਰ ਇਹੋ ਜਿਹੇ ਡਰਾਈਵਰਾਂ ਨੂੰ ਗੱਡੀ ਨਾ ਹੀ ਚਲਾਉਣ ਨੂੰ ਦਿਉ ਤਾਂ ਵਧੀਆ ਗੱਲ ਹੈ ਕਿਉਂਕਿ ਜੋ ਹੁਣ ਕਸਟਮਰ ਹੈ ਤੁਹਾਡਾ ਉਹ ਉਹ ਵੀ ਨਿਰਾਸ਼ ਹੋ ਰਿਹਾ ਉਸ ਤੋਂ ਅਤੇ ਓ ਸਾਡੀ ਏ ਇਹੀ ਗਾ ਗੱਲ ਹੈ ਵੀ ਇਹੀ ਕਹਿ ਰਿਹਾ ਤੁਹਾਨੂੰ ਇਹੋ ਜਿਹੇ ਡਰਾਈਵਰਾਂ ਨੂੰ ਥੋੜ੍ਹੀ ਜਿਹੀ ਅਕਲ ਦਿਉ ਅਤੇ ਤੁਸੀਂ ਚੰਗੇ ਭਲੇ ਡਰਾਈਵਰਾਂ ਨੂੰ ਰੱਖੋ ਜਿਹੜੇ ਕਿ ਗੱਲ ਕਰਨ ਜਿਨ੍ਹਾਂ ਨੂੰ ਗੱਲ ਕਰਨ ਦਾ ਵਧੀਆ ਢੰਗ ਹੋਵੇ ਅਤੇ ਵਧੀਆ ਗੱਲ ਕਰਨ ਵਧੀਆ ਬਿਹੇਵ ਕਰਨ ਹੋਰ ਅਗਲੇ ਕਸਟਮਰ ਨੂੰ ਵੀ ਲੱਗੇ ਵੀ ਹਾਂ ਡਰਾਈਵਰ ਚੰਗਾ ਹੈ